ਪੰਜਾਬ ਦੇ ਲੋਕਾਂ ਨੇ ਆਪਣੇ ਸੱਭਰ ਸੱਭਿਆਚਾਰਕ ਵਿਰਾਸਤ ਨੂੰ ਬੜੀ ਸੰਭਾਲ ਕੇ ਰੱਖਿਆ ਹੋਇਆ ਹੈ ਇਹ ਆਪਣੇ ਸੱਭਿਆਚਾਰਕ ਪ੍ਰੋਗਰਾਮ ਬੜੇ ਹੀ ਸ਼ਾਨੋ ਸ਼ੌਕਤ ਨਾਲ ਮਨਾਉਂਦੇ ਹਨ ਜਿਵੇਂ ਕਿ ਇਹਨਾਂ ਦੇ ਗੁਰੂਆਂ ਦਾ ਜਨਮ ਦਿਨ ਹੁੰਦਾ ਹੈ ਉਹ ਇਹਨਾਂ ਨੂੰ ਬੜੇ ਹੀ ਖਾਲਸਾਈ ਢੰਗ ਨਾਲ ਮਨਾਉਂਦੇ ਹਨ ਗੁਰੂਆਂ ਦੇ ਜਨਮ ਦਿਨ ਤੋਂ ਇੱਕ ਦਿਨ ਪਹਿਲਾਂ ਇਹ ਸਾਰੇ ਪੂਰੇ ਸ਼ਹਿਰ ਵਿੱਚ ਨਗਰ ਕੀਰਤਨ ਕੱਢਦੇ ਹਨ ਆਤਿਸ਼ਬਾਜ਼ੀ ਚਲਾਉਂਦੇ ਹਨ ਅਤੇ ਬਹੁਤ ਹੀ ਆਨੰਦਮਈ ਤਰੀਕੇ ਨਾਲ ਇਸ ਨੂੰ ਮਨਾਉਂਦੇ ਹਨ ਪੰਜਾਬ ਵਿੱਚ ਲੋਕ ਆਪਣੇ ਮੇਲਿਆਂ ਨੂੰ ਵੀ ਬੜੇ ਉਤਸ਼ਾਹ ਨਾਲ ਮਨਾਉਂਦੇ ਹਨ ਕਈ ਮੇਲੇ ਤਾਂ ਇੱਥੇ ਚਾਰ ਚਾਰ ਹਫ਼ਤੇ ਚਲਦੇ ਹਨ ਜਿੱਦਾਂ ਕਿ ਹੋ ਗਿਆ ਬੱਲੇ ਦਾ ਮੇਲਾ ਅਤੇ ਮੇਲਿਆਂ ਵਿੱਚ ਇਹ ਖੂਬ ਸਾਰੀਆਂ ਮਿਠਾਈਆਂ ਇੱਕ ਦੂਜੇ ਨੂੰ ਵੰਡਦੇ ਹਨ ਲੋਕ ਭੰਗੜੇ ਪਾਉਂਦੇ ਹਨ ਜਿੱਦਾਂ ਕਿ ਵਿਸਾਖੀ ਦੇ ਮੇਲੇ 'ਤੇ ਲੋਕ ਬੜੀ ਚੰਗੀਆਂ ਨਵੇਂ ਕੱਪੜੇ ਪਾ ਕੇ ਨਵੀਆਂ ਪੱਗਾਂ ਪਾ ਕੇ ਭੰਗੜੇ ਪਾਉਂਦੇ ਹਨ ਅਤੇ ਬੜਾ ਹੀ ਉਤਸ਼ਾਹ ਨਾਲ ਹੈ ਇੰਨਾ ਰਿਆਸਤ ਨੂੰ ਮਨਾਉਂਦੇ ਹਨ ਸ਼ਾਇਦ ਹੀ ਕਿਸੇ ਹਿੰਦੁਸਤਾਨ ਦੇ ਕਿਸੇ ਵੀ ਸ਼ਹਿਰ ਵਿੱਚ ਇੱਦਾਂ ਲੋਕ ਆਪਣੇ ਵਿਰਾਸਤ ਨੂੰ ਸੰਭਾਲ ਕੇ ਰੱਖਿਆ ਹੋਵੇ